ਮੋਗੇ ਜ਼ਿਲ੍ਹੇ ਵਿੱਚ ਕਾਫੀ ਸਥਾਨਿਕ ਰਿਹਾਇਸ਼ੀ ਵਿਕਲਪ ਉਪਲਬਧ ਹਨ ਜਿਨ੍ਹਾਂ ਵਿੱਚ ਕੰਮ ਸਿੱਖਿਆ ਲਈ ਆਉਣ ਵਾਲੇ ਲੋਕ ਇੱਥੇ ਰੁਕ ਸਕਦੇ ਹਨ ਇੱਥੇ ਛੋਟੇ ਘਰ ਵੀ ਮਿਲ ਸ ਮਿਲ ਜਾਂਦੇ ਨੇ ਵੱਡੇ ਘਰ ਵੀ ਮਿਲ ਜਾਂਦੇ ਨੇ ਜਿਨ੍ਹਾਂ ਦਾ ਕਿਰਾਇਆ ਤਕਰੀਬਨ ਪੱਚੀ ਸੌ ਤਿੰਨ ਹਜ਼ਾਰ ਦੇ ਲਾਗੇ ਛਾਗੇ ਹੈ ਅਤੇ ਕਾਫੀ ਹੋਰ ਤਰ੍ਹਾਂ ਦੀ ਗੈਸਟ ਹਾਊਸ ਵੀ ਨੇ ਅਤੇ ਪ੍ਰੋਪਰਟੀ ਡੀਲਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਨ੍ਹਾਂ ਨਾਲ ਉਹਨਾਂ ਦੀ ਬਹੁਤ ਮਦਦ ਹੋਵੇਗੀ ਅਤੇ ਉਹਨਾਂ ਨੂੰ ਜਲਦੀ ਵਧੀਆ ਘਰ ਅਤੇ ਘੱਟ ਰੇਟ ਵਿੱਚ ਘਰ ਮਿਲ ਜਾਣਗੇ ਅਤੇ ਉਹ ਸਾਨੂੰ ਹੋਰ ਵੀ ਸਮੱਸਿਆ ਪ੍ਰੋਪਰਟੀ ਦੇ ਨਾਲ ਨਾਲ ਦੱਸ ਦੇਣਗੇ ਜਿੱਦਾਂ ਕਿ ਅਸੀਂ ਖਾਣ ਪੀਣ ਵਗੈਰਾ ਕਿੱਥੋਂ ਵਧੀਆ ਲਿਆ ਕਰ ਲਿਆ ਕ ਲੈ ਕੇ ਵਰਤ ਸਕਦੇ ਹਾਂ ਇਸ ਲਈ ਸਾਨੂੰ ਮੋਗੇ ਵਿੱਚ ਕਾਫੀ ਵਧੀਆ ਅਤੇ ਘੱਟ ਰੇਟ 'ਤੇ ਸਥਾਨਕ ਰਿਹਾਇਸ਼ੀ ਜਗ੍ਹਾ ਵਿਕਲਪ ਬਹੁਤ ਨੇ ਅਤੇ ਆਸਾਨੀ ਨਾਲ ਉਪਲਬਧ ਵੀ ਹਨ